ਮੈਂ ਕਦੇ ਵੀ ਕਿਸੇ ਵਰਕਸ਼ੌਪ ਜਾਂ ਕੁਕਿੰਗ ਕਲਾਸ ਵਿੱਚ ਭਾਗ ਨਹੀਂ ਲਿਆ ਮੈਂ ਜੋ ਵੀ ਸਿੱਖਿਆ ਕੁਕਿੰਗ ਦੇ ਵਿੱਚ ਮੈਂ ਆਪਣੀ ਮਾਤਾ ਤੋਂ ਸਿੱਖਿਆ ਉਹਨਾਂ ਨੇ ਹੀ ਮੈਨੂੰ ਤਰ੍ਹਾਂ ਤਰ੍ਹਾਂ ਦੀ ਤਰ੍ਹਾਂ ਤਰ੍ਹਾਂ ਦੇ ਵਿਅੰਜਨਾਂ ਬਣਾਉਣਾ ਸਿਖਾਇਆ ਅਤੇ ਉ ਉਹਨਾਂ ਦੀ ਇਹ ਕਲਾ ਦੇਣ ਹੈ ਅਤੇ ਮੈਨੂੰ ਇਹ ਜ ਇਹ ਜਿਹਾ ਲੱਗਦਾ ਹੈ ਕਿ ਉਹਨਾਂ ਤੋਂ ਮੈਂ ਜੋ ਸਿੱਖ ਲਿਆ ਉਹ ਮੈਨੂੰ ਕਿਸੇ ਵੀ ਵਰਕਸ਼ੌਪ ਅਤੇ ਕੁਕਿੰਗ ਕਲਾਸਿਸ ਦੇ ਵਿੱਚ ਨਹੀਂ ਸਿਖਾ ਸਿਖਾਇਆ ਜਾ ਸਕਦਾ ਉਹਨਾਂ ਤੋਂ ਮੈਂ ਸਿੱਖਿਆ ਕਿ ਕਿੰਝ ਕਿਵੇਂ ਇੱਕ ਖਾਣੇ ਦੇ ਵਿੱਚ ਪਿਆਰ ਲਿਆ ਲੈ ਕੇ ਆ ਲਿਆ ਸਕਦੇ ਹਾਂ ਅਤੇ ਅੱਗੇ ਮੈਂ ਕਦੇ ਕੁਕਿੰਗ ਕਲਾਸਿਸ ਜੁਆਇਨ ਵੀ ਕੀਤੀ ਤਾਂ ਮੈਂ ਉੱਥੇ ਆਪਣੇ ਜਿਹੜੇ ਹੈ ਸਕਿਲਜ਼ ਉਹਨੂੰ ਉਹਨੂੰ ਨਿਖਾਰਾਂਗੀ ਉਹਦੇ ਉੱਤੇ ਕੰਮ ਕਰਾਂਗੀ ਮੇਰੀ ਮਾਂ ਨੇ ਜੋ ਸਿਖਾਇਆ ਹੈ ਉਹ ਮੇਰੇ ਲਈ ਸਭ ਹੈ ਬਟ ਤਾਂ ਵੀ ਅਗਰ ਮੈਨੂੰ ਮੌਕਾ ਮਿਲਦਾ ਹੈ ਤਾਂ ਮੈਂ ਉਹਤੇ ਹੋਰ ਕੰਮ ਕਰਨਾ ਚਾਹਵਾਂਗੀ ਅਤੇ ਉਹਨਾਂ ਦਾ ਨਾਂ ਰੌਸ਼ਨ ਕਰਨਾ ਚਾਹਵਾਂਗੀ